ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਆਪਣਾ ਬਾਲੀ ਬੁੱਕ ਤੋਂ ਜੀ ਮੈਂ ਯਾਦਵਿੰਦਰਜੀਤ ਸਿੰਘ ਬੋਲਦਾ ਜੀ ਬਾਲੀ ਬੁੱਕ ਤੋਂ ਦੇਖੋ ਕਿਤਾਬਾਂ ਤਾਂ ਆਪਣੇ ਕੋਲ ਨੇ ਆਪਣਾ ਵੱਖ ਵੱਖ ਦੱਤੀਆਂ ਕਲਾਸਮੇਟ ਦੀਆਂ ਮਿਲ ਜਾਣਗੀਆਂ ਤੁਹਾਨੂੰ ਇਹ ਕਾਪੀਆਂ ਕਿਤਾਬਾਂ ਵੀ ਨੇ ਸਾਰੀਆਂ ਹਾਂਜੀ ਆਪਾਂ ਨੂੰ ਕਿੰਨੀਆਂ ਚਾ ਚਾਹੀਦੀਆਂ ਨੇ ਹਾਂਜੀ ਦੇਖੋ ਜੇ ਤਾਂ ਤੁਸੀਂ ਲਓਗੇ ਮੇਰੇ ਕੋਲੋਂ ਯਾਨੀ ਕਿ ਕਿਤਾਬਾਂ ਦਾ ਸੈੱਟ ਪੂਰਾ ਅਤੇ ਕਾਪੀਆਂ ਦਾ ਉਹ ਸੈੱਟ ਦਾ ਤੁਹਾਨੂੰ ਯਾਨੀ ਕਿ ਆਪਣਾ ਮਿਲੇਗਾ ਘੱਟ ਤੋਂ ਘੱਟ ਵੀ ਆਪਣਾ ਤਿੰਨ ਹਜ਼ਾਰ ਤੱਕ ਪੱਚੀ ਸੌ ਤਿੰਨ ਹਜ਼ਾਰ ਦੇ ਵਿੱਚ ਵਿੱਚ ਹਾਂਜੀ ਹਾਂਜੀ ਹਾਂਜੀ ਦਰਜਨ ਹੁੰਦੀ ਬਾਰਾਂ ਕਾਪੀਆਂ ਹੋਣਗੀਆਂ ਜੀ ਰੈਤ ਦੇਖੋ ਜੇ ਤਾਂ ਇੱਕ ਜੇ ਤਾਂ ਇੱਕ ਆਪਣਾ ਖਰੀਦੋਗੇ ਕਾਪੀ ਤਾਂ ਤੁਹਾਨੂੰ ਉਹ ਕਾਪੀ ਸੱਠ ਰੁਪਏ ਦੀ ਜੀ ਹਾਂਜੀ ਹਾਂਜੀ ਇੱਕ ਕਾਪੀ ਜੇ ਮੰਨ ਲਓ ਵੀ ਸੈੱਟ ਖਰੀਦਦੇ ਹੋ ਫਿਰ ਤੁਹਾਨੂੰ ਅੱਛਾ ਵੀ ਉਹਦੇ ਵਿੱਚੋਂ ਅਸੀਂ ਕੱਟ ਕੇ ਯਾਨੀ ਕਿ ਪੰਜਾਹ ਰੁਪਏ ਦੀ ਆਪਣਾ ਕਰ ਦਾਂਗੇ ਜੇ ਸੈੱਟ ਖਰੀਦੋਗੇ ਜੇ ਇੱਕ ਕਾਪੀ ਖਰੀਦੋਗੇ ਫਿਰ ਤੁਹਾਨੂੰ ਇੰਨੀ ਦੀ ਜੀ ਲੱਗਣੀ ਸੱਠ ਰੁਪਏ ਦੀ ਹਾਂ ਪੈੱਨ ਦੇਖੋ ਜੀ ਆਪਣੇ ਕੋਲ ਪੈੱਨ ਹੈਗੇ ਨੇ ਚਾਰ ਪੰਜ ਪ੍ਰਕਾਰ ਦੇ ਆਪਣੇ ਕੋਲ ਪਿੰਨ ਹੈ ਹੈਗੇ ਨੇ ਪਾਰਕਰ ਦੇ ਹਾਂਜੀ ਹਾਂਜੀ ਬ੍ਰਾ ਬ੍ਰਾਂਡ 'ਚ ਹੈਗੇ ਨੇ ਆਪਣੇ ਕੋਲ ਛੇ ਸੱਤ ਪ੍ਰਕਾਰ ਦੇ ਨੇ ਜੀ ਪਿੰਨ ਛੇ ਸੱਤ ਪ੍ਰਕਾਰ ਦੇ ਆਉਂਦੇ ਨੇ ਜੀ ਬਰਾਂਡ 'ਚ ਕਲਾਸਮੇਟ ਦਾ ਵੀ ਆਉਂਦਾ ਰਾਈਡ ਦਾ ਵੀ ਅੱਛਾ ਵੀ ਆਉਂਦਾ ਅਤੇ ਪਾਰਕਰ ਦਾ ਵੀ ਆਉਂਦਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਦੇਖੋ ਜੇ ਤਾਂ ਸਾਡੇ ਕੋਲ ਇਕੱਠਾ ਮਾਲ ਚੱਕੋਗੇ ਅਸੀਂ ਤੁਹਾਨੂੰ ਉਹ ਮਾਲ ਦੇ ਵਿੱਚ ਜਿੰਨੀ ਹੋ ਸਕੇਗੀ ਅਸੀਂ ਵੱਧ ਤੋਂ ਵੱਧ ਆਪਣਾ ਕਰਾਂਗੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਠੀਕ ਹੈ ਮੈਂ ਸਾਰਾ ਕੁਛ ਆਪਣਾ ਕਰਕੇ ਨਾ ਪਾ ਕੇ ਠੀਕ ਹੈ ਠੀਕ ਜੀ ਓਕੇ ਓਕੇ ਸਰ ਪਾ ਪਾਦਾਂਗੇ ਪਾਦਾਂਗੇ ਓ ਓਕੇ ਜੀ ਆਪਣਾ ਜੀ ਧੰਨਵਾਦ ਜੀ ਓਕੇ ਥੈਂਕ ਯੂ ਜੀ